ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਿੰਦਰ ਸਿੰਘ ਬੋਲਦਾ ਜੀ ਡੈਰੀ ਵਾਲਾ ਹਾਂਜੀ ਹਾਂਜੀ ਸਾਡੀ ਕਾਫੀ ਪੁਰਾਣੀ ਆ ਜੀ ਵੀਹ ਵੀਹ ਸਾਲ ਹੋ ਗਏ ਹੋਣਗੇ ਘੱਟੋ ਘੱਟ ਹਾਂਜੀ ਹਾਂ ਬਹੁਤ ਵਧੀਆ ਪ੍ਰੋਡਕਟ ਮਿਲਦੇ ਆ ਦੁੱਧ ਦੇ ਸਾਰੇ ਜੀ ਠੀਕ ਆ ਜੀ ਅੱਛਾ ਜੀ ਠੀਕ ਆ ਜੀ ਅੱਛਾ ਜੀ ਅਤੇ ਫੈਟ ਦੇ ਹਿਸਾਬ ਨਾਲ ਲਉਂਗੇ ਦੁੱਧ ਕਿ ਕਿਵੇਂ ਹਾਂ ਐਂ ਨਾ ਫਿਰ ਰੌਲਾ ਨਹੀਂ ਰਹਿੰਦਾ ਵਿਚਾਲੇ ਕੋਈ ਹਾਂਜੀ ਹਾਂ ਠੀਕ ਆ ਜੀ ਠੀਕ ਹੈ ਅਤੇ ਪਨੀਰ ਕਿੰਨਾ ਚਾਹੀਦਾ ਤੁਹਾਨੂੰ ਠੀਕ ਆ ਜੀ ਅਤੇ ਦੁੱਧ ਜੀ ਠੀਕ ਆ ਜੀ ਅਤੇ ਮੱਖਣ ਨਹੀਂ ਮੈਂ ਕਰੀ ਜਾਂਦਾ ਨਾਲ ਦੀ ਨਾਲ ਜੀ ਅਤੇ ਆਹ ਪੁੱਛਦਾ ਸੀ ਮੱਖਣ ਕਿੰਨਾ ਚਾਹੀਦਾ ਹਾਂਜੀ ਹਾਂ ਭੇਜਾਂਗਾ ਸੁਨੇਹਾ ਮਤਲਬ ਹੈਗਾ ਨਾ ਸੀ ਮੱਖਣ ਕਿੰਨਾ ਚਾਹੀਦਾ ਜੀ ਤੁਹਾਨੂੰ ਅੱਛਾ ਜੀ ਠੀਕ ਹੈ ਜੀ ਅਤੇ ਹੋਰ ਕੋਈ ਹੋਰ ਕੋਈ ਵਰਾਇਟੀ ਠੀਕ ਹੈ ਜੀ ਕਿਹੜਾ ਹਲਵਾਈ ਹੈ ਜੀ ਤੁਹਾਡੇ ਅੱਛਾ ਜੀ ਤੁਸੀਂ ਫਿਰ ਉੱਧਰ ਕਰ ਲਿਓ ਗੱਲ ਤੁਹਾਨੂੰ ਸਾਰੀ ਲਿਸਟ ਸਾਨੂੰ ਦੱਸ ਦਿਓ ਫਿਰ ਕ ਕਰਕੇ ਹਾਂਜੀ ਹਾਂ ਵਧੀਆ ਇੱਕ ਤਾਂ ਵਧੀਆ ਚੀਜ਼ ਮਿਲੂ ਤੁਹਾਨੂੰ ਕੋਈ ਐਂ ਕਰਨ ਦੀ ਲੋੜ ਨਹੀਂ ਹਾਂ ਪੈਸੇ ਬਾਅਦ 'ਚ ਦਿਓ ਜਦੋਂ ਤੁਹਾਨੂੰ ਚੀਜ਼ ਪਹੁੰਚ ਗਈ ਜਾਂ ਵਰਤ ਲਈ ਹਾਂਜੀ ਹਾਂ ਉਹ ਲੈਂਦੇ ਆ ਤੁਹਾਡੇ ਪਿੰਡ ਵਾਲੇ ਸਾਰੇ ਠੀਕ ਹੈ ਜੀ ਹਾਂਜੀ ਹਾਂ ਨਾ ਨਾ ਰੇਟ ਵੀ ਤੁਹਾਨੂੰ ਜਾਇਜ਼ ਲੱਗੂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਹਾਂਜੀ ਅਤੇ ਉਹ ਤੁਸੀਂ ਹਲਵਾਈ ਨਾਲ ਕਰਕੇ ਨਾ ਗੱਲ ਜਿੰਨਾ ਸਾਰਾ ਸਮਾਨ ਤੁਹਾਨੂੰ ਚਾਹੀਦਾ ਅਤੇ ਵੀ ਮਤਲਬ ਘਿਓ ਦੁੱਧ ਹਾਂ ਪਨੀਰ ਵਗੈਰਾ ਅਤੇ ਇੱਕ ਸਾਨੂੰ ਹਾਂ ਟਾਈਮ ਜ਼ਰੂਰ ਦੱਸਿਓ ਹਾਂਜੀ ਹਾਂ ਤੁਹਾਨੂੰ ਕੋਈ ਉਲਾਂਭਾ ਨਹੀਂ ਆਊਗਾ ਹਾਂ ਬਾਜ਼ਾਰ ਨਾਲੋਂ ਰੇਟ ਦਾ ਵੀ ਫਰਕ ਹੋਊਗਾ ਰੇਟ ਵਧੀਆ ਮਿਲੂ ਤੁਹਾਨੂੰ ਹਾਂਜੀ ਹਾਂ ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ ਭੇਜ ਦਿਓ ਮੈਨੂੰ ਲਿਸਟ ਹੈ ਜੀ ਹਾਂ ਇਸ ਨੰਬਰ 'ਤੇ ਹਾਂ ਹਾਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ